ਅੱਜ ਦੇ ਜਮਾਨੇ ਵਿੱਚ ਭੌਤਿਕ ਕਿਤਾਬਾਂ ਜਾਂ ਇਲੈਕਟਰੋਨਿਕ ਸੰਸਕਰਣਾਂ ਦਾ ਬਹੁਤ ਹੀ ਟਰੈਂਡ ਆ ਗਿਆ ਹੈ ਅਤੇ ਮੈਨੂੰ ਵੀ ਭੌਤਿਕ ਕਿਤਾਬਾਂ ਜਾਂ ਇਲੈਕਟਰੋਨਿਕ ਸੰਸਕਰਣਾਂ ਨੂੰ ਪੜ੍ਹਨਾ ਚੰਗਾ ਲੱਗਦਾ ਹੈ ਭੌਤਿਕ ਕਿਤਾਬਾਂ ਨੂੰ ਕਹਿੰਦੇ ਨੇ ਕਿ ਬੁੱਕਸ ਅਤੇ ਇਲੈਕਟਰੋਨਿਕ ਸੰਸਕਰਨ ਨੂੰ ਈ ਬੁੱਕਸ ਦੇ ਨਾਮ ਨਾਲ ਜਾਣਿਆ ਜਾਂਦਾ ਅੱਜ ਦੇਖੋ ਜਿਵੇਂ ਜ਼ਿੰਦਗੀ ਇੰਨੀ ਤੇਜ਼ ਚੱਲ ਰਹੀ ਹੈ ਬੰਦੇ ਕੋਲ ਟਾਈਮ ਨਹੀਂ ਹੈ ਲਾਈਬ੍ਰੇਰੀ ਜਾਏ ਕਿਤਾਬ ਉਹ ਲੱਭੇ ਫਿਰ ਪੜ੍ਹੇ ਕਈ ਵਾਰੀ ਬੜਾ ਮੂਡ ਹੁੰਦਾ ਕਿਉਂ ਇੱਕ ਵਧੀਆ ਕਿਤਾਬ ਪੜ੍ਹੀਏ ਪਰ ਲਾਈਬ੍ਰੇਰੀ ਜਾਣ ਦਾ ਵੀ ਨਹੀਂ ਟਾਈਮ ਹੁੰਦਾ ਬਾਜ਼ਾਰ ਜਾਂਦਾ ਵੀ ਨਹੀਂ ਟਾਈਮ ਹੁੰਦਾ ਤਾਂ ਉਸ ਹਿਸਾਬ ਨਾਲ ਜਿਹੜਾ ਹੈ ਅੱਜ ਦੇ ਜਮਾਨੇ ਦੇ ਵਿੱਚ ਇਹਨਾਂ ਕਿਤਾਬਾਂ ਦਾ ਬਹੁਤ ਫਾਇਦਾ ਹੁੰਦਾ ਹੈ ਇਹਦੇ ਲਈ ਮ ਬੰਦਾ ਕੀ ਕਰਦਾ ਸਿਰਫ ਨੈੱਟ 'ਤੇ ਜਾਓ ਆਪਣੇ ਮਨਪਸੰਦ ਰਾਈਟਰ ਦੀ ਬੁੱਕ ਜਿਹੜੀ ਡਾਊਨਲੋਡ ਕਰੋ ਬਸ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਕਿਤਾਬ ਦਾ ਅਤੇ ਡਾਊਨਲੋਡ ਕਰੋ ਅਤੇ ਫਿਰ ਅਸੀਂ ਉਹਨਾਂ ਕਿਤਾਬਾਂ ਨੂੰ ਆਰਾਮ ਨਾਲ ਜਿੱਥੇ ਵੀ ਬੈਠੇ ਹੋਈਏ ਸਫ਼ਰ ਕਰ ਰਹੇ ਹੋਈਏ ਘਰ 'ਚ ਇਕੱਲੇ ਬੈਠੇ ਹੋਈਏ ਜਾਂ ਵੈਸੇ ਦਿਲ ਕਰ ਰਿਹਾ ਹੋਵੇ ਕੋਈ ਵਧੀਆ ਕਿਤਾਬ ਪੜ੍ਹਨ ਦਾ ਤਾਂ ਅਸੀਂ ਬੜੇ ਆਰਾਮ ਨਾਲ ਆਪਣੀ ਕਿਤਾਬ ਨੂੰ ਪੜ੍ਹ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਨੇ ਆਡੀਓ ਬੁੱਕਾਂ ਆਡੀਓ ਬੁੱਕਾਂ ਵੀ ਬਹੁਤ ਫਾਇਦਾ ਦਿੰਦੀਆਂ ਨੇ ਅੱਜ ਦੇ ਜਮਾਨੇ ਦੇ ਵਿੱਚ ਤਾਂ ਮੈਂ ਕਿੰਨੀਆਂ ਕਈ ਬੁੱਕਸ ਪੜ੍ਹ ਵੀ ਚੁੱਕੇ ਹਾਂ ਜਦੋਂ ਵੀ ਮੈਨੂੰ ਟਾਈਮ ਹੁੰਦਾ ਤਾਂ ਮੈਂ ਆਰਾਮ ਨਾਲ ਆਡੀਓ ਬੁੱਕ ਉਹਦੇ 'ਚੋਂ ਕਰ ਲੈਂਦੀ ਹਾਂ ਅਤੇ ਉਹਦੇ 'ਚੋਂ ਸੁਣ ਵੀ ਲੈਂਦੀ ਹਾਂ ਕਿਉਂਕਿ ਉਹਦੇ 'ਚ ਤਾਂ ਤੁਹਾਨੂੰ ਪੜ੍ਹਨ ਦੀ ਵੀ ਨਹੀਂ ਲੋੜ ਉਹ ਜਿਹੜਾ ਹੈ ਬੋਲਣ ਵਾਲੇ ਨੇ ਆਪਣੀ ਬੁੱਕ ਦੇ ਵਿੱਚ ਆਪਣਾ ਮੈਟਰ ਬੋਲ ਦਿੱਤਾ ਹੁੰਦਾ ਹੈ ਜਿਵੇਂ ਗੁਲਾਮੀ ਸਰਦਾਰੀ ਅ ਅਤੇ ਅੰਮ੍ਰਿਤਾ ਪ੍ਰੀਤਮ ਦੀ ਇੱਕ ਦੀਵਾ ਵੀ ਮੈਂ ਇਹਦੇ ਇਸ ਤਰ੍ਹਾਂ ਹੀ ਸੁਣੀ ਹੈ ਇੱਕ ਮੈਡਮ ਹੈਗੇ ਨੇ ਡੀ ਕੇ ਸੈਣੀ ਉਹ ਕੀ ਕਰਦੇ ਨੇ ਕਿ ਉਹ ਰੋਜ਼ ਥੋੜ੍ਹੇ ਜਿਹੇ ਥੋਟਸ ਪਾਉਂਦੇ ਨੇ ਅੱਜ ਕੱਲ੍ਹ ਓਸ਼ ਓਸ਼ੋ ਦੇ ਹੀ ਉਹ ਥੋਟਸ ਪਾ ਰਹੇ ਨੇ ਮਰਨ ਨੂੰ ਰਾਜੀ ਅੱਜ ਹੀ ਮੈਂ ਪੜ੍ਹਿਆ ਸੀ ਮੈਨੂੰ ਬੜਾ ਵਧੀਆ ਲੱਗਿਆ ਤਾਂ ਇਸ ਤਰ੍ਹਾਂ ਬੜਾ ਫਾਇਦਾ ਅੱਜ ਦੇ ਜਮਾਨੇ ਦੇ ਵਿੱਚ ਇਹਨਾਂ ਚੀਜ਼ਾਂ ਦਾ